ਹੈਲੋ ਸਤਿ ਸ਼੍ਰੀ ਅਕਾਲ ਜੀ ਅੱਛਾ ਅੱਛਾ ਹਾਂਜੀ ਹਾਂਜੀ ਪਹਿਚਾਣ ਗਿਆ ਹਾਂਜੀ ਹਾਂਜੀ ਅੱਛਾ ਜੀ ਠੀਕ ਹੈ ਹਾਂਜੀ ਸਰ ਕੋਈ ਨਹੀਂ ਹੋ ਜਾਏਗੀ ਉਹ ਸਰ ਪ੍ਰੋਸੈਸ 'ਤੇ ਇਹਦਾ ਇਜ਼ੀ ਆ ਥੋੜ੍ਹਾ ਜਿੱਦਾਂ ਮਤਲਬ ਕਿ ਤੁਸੀਂ ਡੋਕੂਮੈਂਟ ਵਗੈਰਾ ਪੂਰੇ ਕਰਨੇ ਹੋਣਗੇ ਕੁਝ ਤਾਂ ਬਾਕੀ ਤਾਂ ਮੇਨ ਤਾਂ ਫੀਸ ਵਗੈਰਾ ਲੱਗਦੀ ਉਹਦੀ ਇਹ ਲਗਭਗ ਤੁਸੀਂ ਲਗਾ ਕੇ ਚਲੋ ਮੋਟਾ ਮੋਟਾ ਤੀਹ ਕੁ ਤੀਹ ਕੁ ਹਜ਼ਾਰ ਲੱਗ ਜਾਏਗਾ ਹਾਂਜੀ ਹੋ ਹੀ ਜਾਏਗਾ ਕਰਾ ਦਾਂਗੇ ਕੋਈ ਨਹੀਂ ਬਾਕੀ ਨਾਲ ਤੁਸੀਂ ਪਾਸਵਰਡ ਸਾਈਜ਼ ਫੋਟੋਆਂ ਵਗੈਰਾ ਲੇ ਨਾਲ ਲੇ ਲੈ ਲਿਓ ਹਾਂਜੀ ਹਾਂਜੀ ਠੀਕ ਆ ਭਾਅ ਜੀ ਓਕੇ ਸਰ